ਪੁਰਾਣੇ ਗੀਤ ਜੀ ਬਹੁਤ ਹੀ ਵਧੀਆ ਬਹੁਤ ਹੀ ਸਹੀ ਗਾਇਕਾਂ ਨੇ ਬਣਾਏ ਦੇ ਨੇ ਬਹੁਤ ਹੀ ਜਿਹੜੇ ਬਣਾਉਣ ਵਾਲੇ ਸੀ ਉਹ ਅੱਜ ਤਾਂ ਸ਼ਾਇਦ ਜਿੰਦਾ ਵੀ ਨਹੀਂ ਉਹਨਾਂ ਦੇ ਗਾਣੇ ਨਾ ਹੀ ਅੱਜ ਦੀ ਦੁਨੀਆ 'ਚ ਦੁਬਾਰਾ ਬਣਨੇ ਆ ਅਤੇ ਨਾ ਹੀ ਬਣ ਸਕਦੇ ਆ ਅਤੇ ਨਵੇਂ ਜਿਹੜੇ ਜਿੰਨੇ ਵੀ ਗਾਣੇ ਆ ਰਹੇ ਆ ਬੇਕਾਰ ਜਿਹਦੀ ਵਰਡਿੰਗ ਔਰ ਕੋਈ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਸਿਰਫ ਦਿਖਾਵਾ ਹੀ ਹੈ ਅਤੇ ਮਿਊਜਿਕ ਹੀ ਹੈ ਅਤੇ ਲੇਕਿਨ ਪੁਰਾਣੇ ਗਾਣੇ ਸੁਣ ਕੇ ਦਿਲ ਨੂੰ ਸਕੂਨ ਵੀ ਮਿਲਦਾ ਜੀ ਔਰ ਆਪਣਾ ਬੰਦਾ ਬਹੁਤ ਵਧੀਆ ਆਪਣੇ ਆਪ ਨੂੰ ਫਰੈਸ਼ ਕਰਦਾ ਅਸੀਂ ਜਿੰਨੇ ਵੀ ਗਾਣੇ ਅੱਜ ਸੁਣਦੇ ਹਾਂ ਜਾਂ ਬੋਲਦੇ ਹਾਂ ਮਾੜੇ ਮੋਟੇ ਉਹ ਸਾਰੇ ਪੁਰਾਣੇ ਹੁੰਦੇ ਆ ਨਵਿਆਂ ਦਾ ਸਾਨੂੰ ਪਤਾ ਹੀ ਨਹੀਂ ਇਸ ਲਈ ਪੁਰਾਣੇ ਗਾਣੇ ਬਹੁਤ ਹੀ ਵਧੀਆ ਬਹੁਤ ਹੀ ਚੰਗੇ ਆ ਬਹੁਤ ਹੀ ਪਰਿਵਾਰ 'ਚ ਬਹਿ ਕੇ ਵੀ ਬੰਦਾ ਸੁਣ ਸਕਦਾ ਅੱਜ ਦੇ ਕੋਈ ਵੀ ਗਾਣੇ ਠੀਕ ਨਹੀਂ ਹੈ ਲੇਕਿਨ ਬੇਕਾਰ ਹੈ ਅਤੇ ਇੱਕ ਦਿਮਾਗ ਖਰਾਬ ਕਰਨ ਵਾਲੇ ਆ ਲੇਕਿਨ ਇਹ ਬਹੁਤ ਹੀ ਪੁਰਾਣੇ ਗਾਣੇ ਸੁਣਨ ਦਾ ਮਜ਼ਾ ਵੀ ਆਉਂਦਾ ਔਰ ਬਹੁਤ ਹੀ ਚੰਗਾ ਚੰਗੇ ਨੇ ਇਸ ਲਈ ਪੁਰਾਣੇ ਗਾਣੇ ਓਲਡ ਇਜ ਗੋਲਡ ਹੈ ਜੀ ਲੇਕਿਨ ਬਾਕੀ ਸਭ ਬੇਕਾਰ ਹੈ